ਅਠਾਈ ਸਤੰਬਰ ਉੱਨੀ ਅਠੱਤੀ ਅੱਠ ਮਈ ਵੀਹ ਸੋਲ੍ਹਾਂ ਅਠਾਈ ਜਨਵਰੀ ਵੀਹ ਉੱਨੀ ਦਸ ਮਾਰਚ ਵੀਹ ਵੀਹ ਵੀਹ ਜੂਨ ਵੀਹ ਇੱਕੀ